ਉੱਨੀ ਅਗਸਤ ਉੱਨੀ ਸੌ ਚੁਰਾਨਵੇਂ ਦਸ ਸਪਤੰਬਰ ਉੱਨੀ ਸੌ ਪਚਾਨਵੇਂ ਅੱਠ ਅਪ੍ਰੈਲ ਦੋ ਹਜ਼ਾਰ ਅਠਾਰਾਂ ਗਿਆਰਾਂ ਮਾਰਚ ਦੋ ਹਜ਼ਾਰ ਉੱਨੀ ਇਕ ਮਈ ਦੋ ਹਜ਼ਾਰ ਚੌਵੀ